ਪੰਦਰ੍ਹਾਂ ਨਵੰਬਰ ਉੱਨੀ ਸੌ ਪੰਜਾਹ ਛੇ ਜਨਵਰੀ ਉੱਨੀ ਸੌ ਸੱਤਰ ਅਠਾਰ੍ਹਾਂ ਅਗਸਤ ਉੱਨੀ ਸੌ ਪਚਾਨਵੇਂ ਚਾਰ ਅਪ੍ਰੈਲ ਉੱਨੀ ਸੌ ਨੱਬੇ ਸੌਲ੍ਹਾਂ ਨਵੰਬਰ ਦੋ ਹਜ਼ਾਰ ਤੇਈ